ਕਾਕਾ ਗੱਡੀ ਸਾਈਡ 'ਤੇ ਲੱਗਾ ਆਪਣੀ ਲਾ ਦਿੰਦਾ ਭਾਅ ਜੀ ਅੱਗੇ ਕਿੱਥੇ ਜਾ ਰਹੇ ਹੋ ਗੱਡੀ ਲਗਾਓ ਸਾਈਡ 'ਤੇ ਹਾਂ ਲਗਾਓ ਛੇਤੀ ਲਗਾਓ ਆਪਣੇ ਡੋਕੂਮੈਂਟ ਚੈੱਕ ਕਰਾਓ ਨਾਲ ਲਾਈਸੈਂਸ ਕਿੱਥੇ ਆ ਭਾਅ ਜੀ ਤੁਹਾਡਾ ਘਰ ਰਹਿ ਗਿਆ ਤਾਂ ਤੁਸੀਂ ਕੀ ਕਰ ਰਹੇ ਹੋ ਰੋਡ 'ਤੇ ਜ਼ਰੂਰੀ ਕੰਮ ਕਿਹੜਾ ਸੀ ਭਾਅ ਜੀ ਤੁਹਾਡਾ ਨਾ ਨਾਲ ਨਹੀਂ ਨਾ ਭਾਅ ਜੀ ਤੁਸੀਂ ਲਾਇਸੈਂਸ ਘਰ ਛੱਡਿਆ ਆਪ ਰੋਡ 'ਤੇ ਫਿਰ ਰਹੇ ਹੋ ਇੱਦਾਂ ਥੋੜ੍ਹੀ ਨਾ ਚਲਦਾ ਮੁਆਫ਼ੀ ਭਾਅ ਜੀ ਚਲਾਨ ਹੋਏਗਾ ਤੁਹਾਡਾ ਨਹੀਂ ਮੁਆਫ਼ੀ ਭਾਅ ਜੀ ਕਾਨੂੰਨ ਸਾਰਿਆਂ ਲਈ ਇੱਕ ਬਰਾਬਰ ਆ ਤੁਹਾਨੂੰ ਮੁਆਫ਼ੀ ਕਿੱਦਾਂ ਦੇ ਦੇਈਏ ਭਾਅ ਜੀ ਤੁਹਾਡਾ ਚਲਾਨ ਹੋਏਗਾ ਹੁਣ ਮੁਆਫ਼ੀ ਭਾਅ ਜੀ ਕਿੰਨੀ ਬੜੇ ਜਾਣੇ ਭਾਅ ਜੀ ਤੁਹਾਡੇ ਵਰਗੇ ਟੱਕਰਦੇ ਆ ਡੇਲੀ ਮੁਆਫ਼ੀ ਮੁਆਫ਼ੀ ਕਰਦੇ ਆ ਲਸੈਂਸ ਬਣਾਇਆ ਦਾ ਨਹੀਂ ਹੁੰਦਾ ਘਰੋਂ ਘਰ ਭਾਅ ਜੀ ਕਿੰਨੀ ਕੁ ਦੂਰ ਆ ਤੁਹਾਡਾ ਇੱਥੋਂ ਕਿੰਨਾ ਕੁ ਟਾਈਮ ਲੱਗੇਗਾ ਕਿੰਨਾ ਕੁ ਟਾਈਮ ਲੱਗੇਗਾ ਤੁਹਾਨੂੰ ਪੰਜ ਮਿੰਟ ਅਤੇ ਪੰਜ ਮਿੰਟ 'ਚ ਜੇ ਨਹੀਂ ਆਏ ਵਾਪਸ ਤਾਂ ਜਲਦੀ ਆ ਜਾਇਓ ਫਿਰ ਵਾਪਸ